ਬਿਮਾਰ ਮਰੀਜ਼ ਵਾਸਤੇ ਘਰਾਂ ਵਿੱਚ ਹਲਕਾ ਫੁਲਕਾ ਖਾਣਾ ਬਣਾਇਆ ਜਾਂਦਾ ਹੈ ਜਿਵੇਂ ਉਸ ਮਰੀਜ਼ ਨੂੰ ਮਿਰਚ ਮਸਾਲਾ ਖਾਣਾ ਬੰਦ ਕੀਤਾ ਜਾਂਦਾ ਹੈ ਅਤੇ ਖਾਣ ਵਿੱਚ ਵੀ ਹਲਕਾ ਖਾਣਾ ਦਿੱਤਾ ਜਾਂਦਾ ਹੈ ਕਿ ਤਾਂ ਜੋ ਕਿ ਮਰੀਜ਼ ਖਾਣਾ ਆਸਾਨੀ ਨਾਲ ਪਚਾ ਸਕੇ ਜਿਵੇਂ ਤੁਸੀਂ ਲਾ ਲਓ ਖਿਚੜੀ ਇੱਕ ਨਮਕੀਨ ਖਾਣਾ ਹੈ ਇਸ ਨੂੰ ਇਸ ਨੂੰ ਬਣਾਉਣ ਲਈ ਦਾਲ ਅਤੇ ਚੌਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਖਿਚੜੀ ਨੂੰ ਖਿਚੜੀ ਨੂੰ ਪਤਲੀ ਪਤਲਾ ਬਣਾਇਆ ਜਾਂਦਾ ਹੈ ਦਲੀਆ ਇੱਕ ਮਿੱਠਾ ਖਾਣਾ ਹੈ ਇਸ ਨੂੰ ਨਮਕੀਨ ਵੀ ਬਣਾਇਆ ਜਾ ਸਕਦਾ ਹੈ ਦਲੀਆ ਵੀ ਪਤਲਾ ਬਣਾਇਆ ਜਾ ਸਕਦਾ ਇਹ ਵੀ ਆਸਾਨੀ ਨਾਲ ਪਚਾਇਆ ਜਾਂਦਾ ਹੈ ਮਰੀਜ਼ ਨੂੰ ਕਮਜ਼ੋਰੀ ਹੋਣ ਕਾਰਨ ਦਲੀਆ ਜ਼ਿਆਦਾ ਦਿੱਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਇਸ ਇਸ ਤਾਕਤ ਵਾਲਾ ਹੁੰਦਾ ਹੈ ਦਲੀਆ ਦਾਲ ਦੀ ਵਰਤੋਂ ਵੀ ਮਰੀਜ਼ ਨੂੰ ਰੋਟੀ ਨਾਲ ਖਾਣ ਲਈ ਦਿੱਤੀ ਜਾਂਦੀ ਹੈ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਹਰੀਆਂ ਸਬਜ਼ੀਆਂ ਦੇ ਸੂਪ ਬਣਾ ਕੇ ਵੀ ਦਿੱਤੇ ਜਾਂਦੇ ਹਨ ਚਨਿਆਂ ਦੀ ਦਾਲ ਅਤੇ ਛੋਲਿਆਂ ਦਾ ਸੂਪ ਉਬਾਲ ਕੇ ਸਪਰੋਊਟ ਤਿਆਰ ਕੀਤਾ ਜਾਂਦਾ ਹੈ ਫਲਾਂ ਦੀ ਕਿਓਰੀ ਅਤੇ ਜੂਸ ਬਣਾ ਕੇ ਦਿੱਤਾ ਜਾਂਦਾ ਹੈ